ਸਾਡੇ ਘਰ ਦੇ ਵਿੱਚ ਬਿਜਲੀ ਜਿਹੜੀ ਹੈ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਤਾਂ ਹੁਣ ਬਿਜਲੀ ਦੀ ਬਹੁਤ ਜਾਣ ਬਹੁਤ ਘੱਟ ਸਮੱਸਿਆ ਹੈਗੀ ਆ ਜੇ ਆਪਾਂ ਦੇਖ ਲਈਏ ਪੰਜਾਬ ਦੇ ਵਿੱਚ ਵੈਸੇ ਤਾਂ ਇਸ ਵੇਲੇ ਚੌਵੀ ਘੰਟੇ ਬਿਜਲੀ ਹੈਗੀ ਪਰ ਵੱਖ ਵੱਖ ਸਮਿਆਂ ਦੇ ਉੱਤੇ ਜਦੋਂ ਮੌਸਮ ਬਦਲਦਾ ਆ ਖਾਸ ਤੌਰ 'ਤੇ ਜਦੋਂ ਬਰਸਾਤ ਆਉਂਦੀ ਹੈ ਤਾਂ ਬਰਸਾਤ ਵਿੱਚ ਮੀਂਹ ਪੈਣ ਕਰਕੇ ਜਿਹੜੀ ਜਾਂ ਜਿਹੜੇ ਦਰੱਖਤ ਡਿੱਗਣ ਕਰਕੇ ਜਾਂ ਖੰਭੇ ਤਾਰਾਂ ਡਿੱਗਣ ਕਰਕੇ ਕਈ ਵਾਰੀ ਜਿਹੜੇ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਉਸ ਦੇ ਨਾਲ ਜਿਹੜੀ ਹੈ ਜ਼ਿੰਦਗੀ ਕਈ ਵਾਰ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਲਾਈਟ ਦੇ ਬਿਨਾਂ ਅਧੂਰਾ ਅਧੂਰਾ ਲੱਗਦਾ ਹਨੇਰਾ ਲੱਗਦਾ ਹੈ ਅਤੇ ਇਸ ਕਰਕੇ ਬਹੁਤ ਸਾਰੇ ਆਪਾਂ ਸਟੱਡੀ ਨਹੀਂ ਕਰ ਸਕਦੇ ਅਖ਼ਬਾਰ ਨਹੀਂ ਪੜ੍ਹ ਸਕਦੇ ਜੇ ਆਪਾਂ ਦੇਖ ਲਈਏ ਤਾਂ ਲਾਈਟ ਤੋਂ ਬਿਨਾਂ ਫਿਰ ਜੇ ਗਰਮੀਆਂ ਦਾ ਮੌਸਮ ਹੈ ਤਾਂ ਪੱਖੇ ਕੂਲਰ ਏ ਸੀ ਚੱਲਣ ਤੋਂ ਬਿਨਾਂ ਜਿਹੜਾ ਜੀਵਨ ਅੱਜ ਕੱਲ੍ਹ ਬੜਾ ਪ੍ਰਭਾਵਿਤ ਹੁੰਦਾ ਹੈ ਅਤੇ ਜੇ ਆਪਾਂ ਲਾਈਟ ਦੀ ਸਮੱਸਿਆ ਕਰਕੇ ਜਿਹੜੀ ਰੋਸ਼ਨੀ ਨਾ ਹੋਵੇ ਤਾਂ ਬੰਦਾ ਇਕ ਕਿਸਮ ਦਾ ਲਾਚਾਰ ਨਜ਼ਰ ਆਉਂਦਾ ਜੇ ਦੇਖ ਲਈਏ ਆਪਾਂ ਗਰਮੀਆਂ ਦੇ ਵਿੱਚ ਜੇ ਲਾਇਟ ਕਿਸੇ ਕਾਰਨ ਕੱਟ ਹੋ ਜਾਵੇ ਹਨੇਰੇ ਕਰਕੇ ਖਾਸ ਤੌਰ 'ਤੇ ਗਰਮੀਆਂ ਦੇ ਵਿੱਚ ਜ਼ਿਆਦਾ ਕੱਟ ਹੁੰਦੀ ਹੈ ਜਾਂ ਬਰਸਾਤ ਦੇ ਵਿੱਚ ਤਾਂ ਫਿਰ ਜਿਹੜੀ ਆ ਅ ਗਰਮੀ ਏ ਸੀ ਪੱਖੇ ਇਹ ਚੱਲਣੇ ਮੁਸ਼ਕਿਲ ਹੋ ਜਾਂਦੇ ਹੈ ਤਾਂ ਥੋੜ੍ਹੀ ਜ਼ਿੰਦਗੀ ਮੁਸ਼ਕਿਲ ਲੱਗਦੀ ਹੈ ਇਸ ਤਰ੍ਹਾਂ ਜੇ ਸਰਦੀਆਂ ਦੀ ਅਸੀਂ ਗੱਲ ਕਰ ਲਈਏ ਸਰਦੀਆਂ ਦੇ ਵਿੱਚ ਜੇ ਲਾਈਟ ਕਿਸੇ ਕਾਰਨ ਚਲੇ ਜਾਂਦੀ ਹੈ ਤਾਂ ਕੀ ਹੈ ਗੀਜ਼ਰ ਨਹੀਂ ਚੱਲਦਾ ਠੰਡੇ ਪਾਣੀ ਨਾਲ ਨਹਾਉਣਾ ਪੈਂਦਾ ਹੈ ਅਤੇ ਹੀਟਰ ਨਹੀਂ ਚੱਲਦੇ ਹੈ ਤਾਂ ਇਸ ਕਰਕੇ ਠੰਡੇ ਮੌਸਮ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਹੈ ਜਿਹੜੀ ਬਿਜਲੀ ਆ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਅੱਜ ਅਹਿਮ ਰੋਲ ਨਿਭਾਉਦੀ ਹੈ ਕਿਸੇ ਕਾਰਨ ਵੀ ਜੇ ਕੱਟ ਲੱਗਦੇ ਹਨ ਤਾਂ ਉਸ ਦੇ ਨਾਲ ਜਿਹੜਾ ਹੈ ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਕਰਕੇ ਜਿਹੜੀ ਆ ਬਿਜਲੀ ਆ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀ ਹੈ ਇਸ ਨੂੰ ਸਰਕਾਰਾਂ ਨੂੰ ਜਾਂ ਲੋ ਹੋਰ ਵੀ ਸੁਹਿਰਦ ਕਰਨ ਦੀ ਲੋੜ ਹੈ